ਹੈਲੋ ਸ਼ੱਸ਼ੀਕਾਲ ਮੈਮ ਹਾਂਜੀ ਦੱਸੋ ਜੀ ਅਸੀਂ ਤੁਹਾਨੂੰ ਕੀ ਸੇਵਾਵਾਂ ਪ੍ਰੋਵਾਈਡ ਕਰਵਾ ਸਕਦੇ ਆਂ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਸਾਡੇ ਕੋਲ ਸਾਰੇ ਮਾਡਲ ਪ੍ਰੋਵਾਈਡ ਲੇਟੈਸਟ ਜਿਹੜੇ ਨਵੇਂ ਆ ਰਹੇ ਹੈ ਓਪੋ ਕੰਪਨੀ ਦੇ ਹੈ ਵੀਵੋ ਦੇ ਹੈ ਆਈਫੋਨ ਹੈ

ਹਾਂਜੀ ਡਿਸਕਾਊਂਟ ਤੁਹਾਨੂੰ ਫਲਿਪ ਕਾਰਟ 'ਤੇ ਵੀਹ ਪ੍ਰਸੈਂਟ ਆਫ ਹੋਏ ਦੇ ਤਾਂ ਅਸੀਂ ਤੁਹਾਨੂੰ ਉਸ ਤੋਂ ਵੀ ਲੈਸ ਕਰਕੇ ਦੱਸਾਂਗੇ ਤੇ ਤੁਹਾਨੂੰ ਕੀਮਤ ਵਿੱਚ ਵੀ ਛੋਟ ਦੇਵਾਂਗੇ ਹਾਂਜੀ ਤੁਸੀਂ ਕਿਸ ਤਰ੍ਹਾਂ ਦਾ ਫੋਨ ਕਿਹੜਾ ਮਾਡਲ ਖਰੀਦਣਾ ਚਾਹੁੰਦੇ ਹੋ ਤੇ ਰੇਂਜ ਵੀ ਵਧੀਆ ਹਾਂਜੀ ਹਾਂਜੀ ਵੀਵੋ ਮਾਡਲ ਦੱਸੋ ਹਾਂਜੀ ਉਸ ਦਾ ਪ੍ਰਾਈਜ ਹੈਗਾ ਸਤਾਰਾਂ ਕੁ ਹਜਾਰ ਆਨਲਾਈਨ ਤੇ ਅਸੀਂ ਤੁਹਾਨੂੰ ਸਾਢੇ ਸੋਲਾਂ ਹਜਾਰ ਦਾ ਦੇ ਦਵਾਂਗੇ ਨਾਲ ਵੀ ਇਹਦੇ ਇੱਕ ਬੈਨੀਫਿਟ ਹੋਰ ਤੁਹਾਨੂੰ ਮੁਨਾਫਾ ਦੇਵਾਂ ਤੇ ਨਾਲ ਕਵਰ ਫਰੀ ਦੇਵਾਂਗੇ ਤੇ ਨਾਲ ਇਕ ਏਅਰ ਫੋਨ ਵੀ ਤੁਹਾਨੂੰ ਗਿਫਟ ਕਰਦਾਂਗੇ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਉਹਦੇ ਵਿੱਚ ਚਾਰਜਰ ਕੇਬਲ ਤੇ ਸਭ ਕੁਝ ਮਿਲੇਗਾ ਨਾਲ ਸਾਲ ਦੀ ਵਰੰਟੀ ਮਿਲੇਗੀ ਤੁਹਾਨੂੰ ਕੋਈ ਵੀ ਉਹਦੇ 'ਚ ਦਿੱਕਤ ਆਉਂਦੀ ਆ ਫੋਨ ਖਰਾਬ ਹੋ ਜਾਂਦਾ ਜਾਂ ਕੋਈ ਵੀ ਹੋਰ ਸਮੱਸਿਆ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਦੁਬਾਰਾ ਨਵਾਂ ਫੋਨ ਦੇਵਾਂਗੇ ਹਾਂਜੀ ਤੁਹਾਨੂੰ ਅੱਠ ਜੀਬੀ ਰੈਮ ਆ ਅੱਠ ਜੀ ਬੀ ਰੈਮ ਤੇ ਇੱਕ ਸੋ ਛੱਬੀ ਜੀਬੀ ਡਾਟਾ ਓ ਜੀ ਦੂਸਰੀ ਮਿਲੇਗੀ ਜੀਬੀ ਹਾਂਜੀ ਨਹੀਂ ਨਹੀਂ ਸਾਡੇ ਕੋਲ ਸਾਰੇ ਮਾਡਲ ਹੈਗੇ ਆ ਹਾਂਜੀ ਬਾਕੀ ਤੁਸੀਂ ਆ ਜਿਓ ਜੇ ਦੁਕਾਨ ਤੇ ਤੁਹਾਨੂੰ ਜੇਲਾਂ ਹੋਰ ਵੀ ਫੋਨ ਵਿਖਾ ਦਵਾਂਗੇ ਜੋ ਤੁਹਾਨੂੰ ਵਧੀਆ ਲੱਗੇ ਪਸੰਦ ਆਵੇ ਤੇ ਉਹ ਲੈ ਲਿਆ ਜੇ ਫਿਰ ਤੁਹਾਨੂੰ ਰੇਟ ਵਿੱਚ ਵੀ ਅਸੀਂ ਛੋਟ ਦੇ ਦਮਗੇ ਹੋਰ ਵੀ ਨਵੇਂ ਮਾਡਲ ਆਏ ਤੇ ਆ ਨਵੇਂ ਹਾਂਜੀ ਹਾਂਜੀ ਤੁਹਾਨੂੰ ਸਾਰੇ ਕਲਰਸ ਮਿਲ ਜਾਣਗੇ ਜਿਲੇ ਵੀ ਤੁਸੀਂ ਰੰਗ ਚਾਹਦੇ ਹੋ ਤੁਹਾਨੂੰ ਪਸੰਦ ਹੋਏ ਤਾਂ ਹਾਂਜੀ ਹਾਂਜੀ